ਸਾਡੇ ਘਰ ਦਾ ਇੱਕ ਮੁੱਖ ਪਾਰਟ ਹੈ ਜਿਸ ਨੂੰ ਕਿਹਾ ਜਾਂਦਾ ਹੈ ਰਸੋਈ ਹਰ ਇੱਕ ਘਰਾਂ ਵਿੱਚ ਰਸੋਈ ਸਭ ਨੂੰ ਹੀ ਆਮ ਦੇਖਣ ਨੂੰ ਮਿਲਦੀ ਹੈ ਰਸੋਈ ਦੇ ਵਿੱਚ ਇੱਕ ਖ਼ਾਸ ਤੌਰ 'ਤੇ ਭੂਮਿਕਾ ਨਿਭਾਉਂਦੇ ਹਨ ਰਸੋਈ ਵਿੱਚ ਰੱਖੇ ਗਏ ਬਰਤਨ ਹਰ ਇੱਕ ਔਰਤ ਰਸੋਈ ਦੇ ਵਿੱਚ ਬਰਤਨਾਂ ਨੂੰ ਇੱਕ ਇੱਕ ਢੰਗ ਤਰੀਕੇ ਦੇ ਨਾਲ ਰੱਖਦੀ ਹੈ ਰਸੋਈ ਦੇ ਵਿੱਚ ਬਹੁਤ ਸਾਰੇ ਬਰਤਨ ਪਾਏ ਜਾਂਦੇ ਹਨ ਜਿਹਨਾਂ ਬਰਤਨਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸਾਡੇ ਘਰ ਵਿੱਚ ਜਿਸ ਤਰ੍ਹਾਂ ਕਿ ਜਿਹਨਾਂ ਬਰਤਨਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਉਹ ਬਰਤਨ ਅਸੀਂ ਨੇੜੇ ਨੇੜੇ ਰੱਖਦੇ ਹਾਂ ਅਤੇ ਜਿਹਨਾਂ ਬਰਤਨਾਂ ਦੀ ਵਰਤੋਂ ਕਦੇ ਕਦੇ ਜਾਂ ਬਹੁਤ ਜ਼ਿਆਦਾ ਘੱਟੋ ਘੱਟ ਹੁੰਦੀ ਹੈ ਜਾਂ ਫਿਰ ਕਦੇ ਕਦੇ ਪੰਜ ਛੇ ਦਿਨਾਂ ਬਾਅਦ ਹੋ ਜਾਂਦੀ ਹੈ ਉਨ੍ਹਾਂ ਬਰਤਨਾਂ ਨੂੰ ਥੋੜ੍ਹਾ ਦੂਰ ਰੱਖਿਆ ਜਾਂਦਾ ਹੈ ਸਾਡੀ ਰਸੋਈ ਦੇ ਵਿੱਚ ਇੱਕ ਰੈਕ ਲੱਗਾ ਹੋਇਆ ਹੈ ਰੈਕ ਦੇ ਵਿੱਚ ਅਸੀਂ ਬਰਤਨਾਂ ਨੂੰ ਤਰਤੀਬ ਦੇ ਅਨੁਸਾਰ ਰੱਖਦੇ ਹਾਂ ਜਿਵੇਂ ਕਿ ਕਿ ਬਰਤਨਾਂ ਦੀ ਕਿਸਮਾਂ ਹਨ ਜਿਵੇਂ ਕਿ ਇਹ ਲਗਾ ਲੋਓ ਤੁਸੀਂ ਗਲਾਸ ਕੌਲੀਆਂ ਚਮਚੇ ਥਾਲੀਆਂ ਪਲੇਟਾਂ ਗੜ੍ਹਵੀਆਂ ਪਤੀਲੇ ਪਤੀਲੀਆਂ ਕੜਾਹੀਆਂ ਕੜਛੀਆਂ ਇਹ ਸਾਰੇ ਬਰਤਨਾਂ ਦੀਆਂ ਕਿਸਮਾਂ ਹਨ ਬਰਤਨਾਂ ਦੀਆਂ ਕਿਸਮਾਂ ਹੋਣ ਦੇ ਨਾਲ ਨਾਲ ਇਹ ਸਾਰੀਆਂ ਸਾਡੇ ਡੇਲੀ ਜਿਹੜੇ ਯੂਜ ਹੈ ਉਹਦੇ ਵਿੱਚ ਆਉਂਦੀਆਂ ਹਨ ਬਰਤਨਾਂ ਨੂੰ ਅਸੀਂ ਸਬਜ਼ੀ ਬਣਾਉਣ ਤੋਂ ਲੈ ਕੇ ਹੋਰ ਸਾਰੇ ਕੰਮਾਂ ਵਿੱਚ ਇਸ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਢੱਕਣਾ ਰੱਖਣਾ ਕਿਸੇ ਚੀਜ਼ ਨੂੰ ਵੀ ਅਸੀਂ ਬਰਤਨਾਂ ਦੀ ਮਦਦ ਦੇ ਨਾਲ ਰੱਖਦੇ ਹਾਂ ਜਦੋਂ ਵੀ ਘਰ ਦੇ ਵਿੱਚ ਔਰਤਾਂ ਸਬਜ਼ੀ ਬਣਾਉਂਦੀਆਂ ਹਨ ਤਾਂ ਸਬਜ਼ੀ ਵੀ ਬਰਤਨ ਦੇ ਵਿੱਚ ਹੀ ਬਣਾਈ ਜਾਂਦੀ ਹੈ ਕੋਈ ਚੀਜ਼ ਸੰਭਾਲ ਕੇ ਰੱਖਣੀ ਹੋਵੇ ਜਿਵੇਂ ਕਿ ਦੁੱਧ ਕੋਈ ਵੀ ਚੀਜ਼ ਲਗਾ ਲਓ ਦੁੱਧ ਦਹੀਂ ਉਸ ਨੂੰ ਵੀ ਬਰਤਨ ਦੇ ਵਿੱਚ ਹੀ ਸੰਭਾਲ ਕੇ ਰੱਖਿਆ ਜਾਂਦਾ ਹੈ ਜਿਵੇਂ ਕਿ ਸਾਡੇ ਘਰ ਦੇ ਵਿੱਚ ਸਬਜ਼ੀ ਬਣਾਉਣ ਦੇ ਲਈ ਕੜਾਹੀ ਵਰਤੀ ਜਾਂਦੀ ਹੈ ਕਿਸੇ ਘਰ ਦੇ ਵਿੱਚ ਫਰਾਈ ਵਿਨ ਵਰਤਿਆ ਜਾਂਦਾ ਹੋਵੇਗਾ ਇਸ ਤਰ੍ਹਾਂ ਜਦੋਂ ਸਬਜ਼ੀ ਬਣਾਈ ਜਾਂਦੀ ਹੈ ਤਾਂ ਕੜਾਹੀ ਦੇ ਵਿੱਚ ਬਣਾਈ ਜਾਂਦੀ ਹੈ ਅਤੇ ਉਸ ਨੂੰ ਜਦੋਂ ਸਬਜ਼ੀ ਬਣਦੀ ਹੈ ਤਾਂ ਉਸ ਨੂੰ ਪਕਾਉਣ ਦੇ ਲਈ ਚੰਗੀ ਤਰ੍ਹਾਂ ਹਿਲਾਇਆ ਜਾਂਦਾ ਹੈ ਉਸ ਨੂੰ ਸਬਜ਼ੀ ਨੂੰ ਹਿਲਾਉਣ ਦੇ ਲਈ ਕੜਛੀ ਵਰਤੀ ਜਾਂਦੀ ਹੈ ਕੜਛੀ ਵੀ ਇੱਕ ਬਰਤਨ ਦੀ ਹੀ ਪ੍ਰਕਾਰ ਹੈ ਇਸ ਤਰ੍ਹਾਂ ਕਿਹਾ ਜਾਂ ਸਕਦਾ ਹੈ ਕਿ ਜੋ ਬਰਤਨ ਹੈ ਬਰਤਨਾਂ ਤੋਂ ਬਿਨ੍ਹਾਂ ਸਬਜ਼ੀ ਨਹੀਂ ਬਣਾਈ ਜਾ ਸਕਦੀ ਸਬਜ਼ੀ ਬਣਾਉਣਾ ਕਿਆ ਹੈ ਜੋ ਮਤਲਬ ਇੱਕ ਪ੍ਰਕਾਰ ਦਾ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਸਾਡੇ ਸਰੀਰ ਦੇ ਲਈ ਪਾਣੀ ਜ਼ਰੂਰੀ ਹੈ ਸਭ ਕੁਛ ਜ਼ਰੂਰੀ ਹੈ ਉਸ ਤਰ੍ਹਾਂ ਕਿਆ ਹੈ ਖਾਣਾ ਪੀਣਾ ਸਾਡੇ ਲਈ ਜ਼ਰੂਰੀ ਹੈ ਔਰ ਖਾਣਾ ਪੀਣਾ ਸਾਡਾ ਜੋ ਵੀ ਹੈ ਇਹ ਬਰਤਨਾਂ ਤੋਂ ਬਿਨ੍ਹਾਂ ਪੂਰਾ ਨਹੀਂ ਹੋ ਸਕਦਾ ਹੈ ਹੈ ਜਿਵੇਂ ਕਿ ਪਾਣੀ ਪੀਣ ਦੇ ਲਈ ਸਾਨੂੰ ਗਲਾਸਾਂ ਦੀ ਜ਼ਰੂਰਤ ਪੈਂਦੀ ਹੈ ਅਸੀਂ ਗਲਾਸ ਦੇ ਵਿੱਚ ਪਾਣੀ ਪਾ ਕੇ ਪੀਂਦੇ ਹਾਂ ਔਰ ਅਸੀਂ ਜਿਵੇਂ ਕਿ ਅਸੀਂ ਵਾਰ ਵਾਰ ਦਿਨ ਦੇ ਵਿੱਚ ਕਿੰਨੀ ਵਾਰ ਪਾਣੀ ਪੀ ਲੈਂਦੇ ਹਾਂ ਉਹ ਪਾਣੀ ਵਾਰ ਵਾਰ ਵਾਰ ਵਾਰ ਪੀਣ ਦੇ ਲਈ ਅਸੀਂ ਕਿਸ ਦੀ ਵਰਤੋਂ ਕਰਦੇ ਹਾਂ ਗਲਾਸਾਂ ਦੀ ਵਰਤੋਂ ਕਰਦੇ ਹਾਂ ਇਹ ਵਾਰ ਵਾਰ ਵਾਰ ਵਾਰ ਵਰਤੋਂ ਕੀਤੇ ਗਏ ਗਲਾਸ ਅਸੀਂ ਆਪਣੀ ਘਰ ਰਸੋਈ ਦੇ ਵਿੱਚ ਨੇੜੇ ਰੱਖਦੇ ਹਾਂ ਤਾਂ ਕਿ ਜੋ ਬਰਤਨ ਹੈ ਹੈ ਔਰ ਜੋ ਇਹ ਬਰਤਨ ਗਲਾਸ ਹੈ ਇਸ ਦੀ ਵਰਤੋਂ ਵਾਰ ਵਾਰ ਹੁੰਦੀ ਰਹਿੰਦੀ ਹੈ ਹੈ ਔਰ ਇਸ ਨੂੰ ਕਿਆ ਹੈ ਬਰਤਨਾਂ ਨੂੰ ਧੋ ਕੇ ਫਿਰ ਤੋਂ ਯੂਜ ਦੇ ਵਿੱਚ ਲਿਆ ਜਾਂਦਾ ਹੈ ਜਿਵੇਂ ਕਿ ਅਸੀਂ ਪਾਣੀ ਪੀਤਾ ਅਤੇ ਗਲਾਸ ਨੂੰ ਰੱਖ ਦਿੱਤਾ ਅਤੇ ਬਾਅਦ ਵਿੱਚ ਕਿਆ ਹੈ ਔਰਤਾਂ ਉਹ ਹੀ ਬਰਤਨਾਂ ਨੂੰ ਧੋ ਮਾਂਜ ਕੇ ਸਾਫ਼ ਕਰਕੇ ਫੇਰ ਰੱਖ ਦਿੰ ਰੱਖ ਦਿੰਦੀਆਂ ਹਨ ਜਿਵੇਂ ਕਿ ਇੱਕ ਬਰਤਨ ਹੈ ਉਹਦੇ ਵਿੱਚ ਅਸੀਂ ਦੁੱਧ ਗਰਮ ਕੀਤਾ ਦੁੱਧ ਗਰਮ ਕਰਨ ਤੋਂ ਜਿੱਦਾਂ ਕਿ ਬਰਤਨ ਲਗਾ ਲਓ ਤੁਸੀਂ ਪਤੀਲੀ ਹੈ ਕਿਸੀ ਪਤੀਲੀ ਦੇ ਵਿੱਚ ਦੁੱਧ ਗਰਮ ਕੀਤਾ ਦੁੱਧ ਗਰਮ ਕਰਨ ਤੋਂ ਬਾਅਦ ਕਿਆ ਕੀਤਾ ਗਿਆ ਉਸ ਬਰਤਨ ਦੇ ਵਿੱਚ ਦੁੱਧ ਗਰਮ ਕੀਤਾ ਗਿਆ ਅਤੇ ਉਹਨੂੰ ਦੁੱਧ ਗਰਮ ਹੋਇਆ ਤਾਂ ਦੁੱਧ ਜਦੋਂ ਠੰਡਾ ਹੋ ਗਿਆ ਉਹਨੂੰ ਕਿਸੇ ਗੜਬੀ ਦੇ ਵਿੱਚ ਪਾ ਕੇ ਰੱਖਿਆ ਗਿਆ ਗੜਬੀ ਤੋਂ ਬਾਅਦ ਅਸੀਂ ਉਹਨੂੰ ਕੀ ਉਹ ਖ਼ਰਾਬ ਨਾ ਹੋ ਜਾਵੇ ਫਰਿੱਜ ਵਿੱਚ ਰੱਖ ਦਿੰਦੇ ਹਾਂ ਫਰਿੱਜ ਵਿੱਚ ਰੱਖ ਦਿੰਦੇ ਹਾਂ ਤਾਂ ਜਿਹੜੀ ਉਹ ਪਤੀਲੀ ਹੋ ਗਈ ਜਿਹੜੇ ਹੋਰ ਭਾਂਡੇ ਸਬਜ਼ੀ ਬਣਾਉਣ ਦੇ ਵਿੱਚ ਕੜਾਹੀ ਖ਼ਰਾਬ ਹੋਈ ਹੈ ਹੈ ਹੈ ਨਾ ਅਤੇ ਉਨ੍ਹਾਂ ਬਰਤਨਾਂ ਨੂੰ ਧੋ ਦਿੱਤਾ ਜਾਂਦਾ ਹੈ ਜਿਵੇਂ ਕਿ ਕੜਾਹੀ ਨੂੰ ਧੋ ਦਿੱਤਾ ਗੜਬੀ ਨੂੰ ਧੋ ਦਿੱਤਾ ਅਤੇ ਪਤੀਲੀ ਜਿਸ ਨੂੰ ਵਿੱਚ ਦੁੱਧ ਨੂੰ ਗਰਮ ਕੀਤਾ ਗਿਆ ਸੀ ਸਬਜ਼ੀ ਬਣਾਈ ਗਈ ਸੀ ਕੜਾਹੀ ਇਹਨਾਂ ਨੂੰ ਧੋ ਦਿੱਤਾ ਜਾਂਦਾ ਹੈ ਧੋਣ ਤੋਂ ਬਾਅਦ ਇਹਨਾਂ ਨੂੰ ਰੱਖ ਦਿੱਤਾ ਜਾਂਦਾ ਹੈ ਹੈ ਰਸੋ ਸੈਲਫ਼ ਦੇ ਉੱਤੇ ਜਾਂ ਫਿਰ ਰੈਕ ਦੇ ਉੱਤੇ ਕਿਤੇ ਵੀ ਜਿੱਥੇ ਬਰਤਨ ਨੂੰ ਰਸੋਈ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਬਰਤਨ ਹੈ ਬਰਤਨਾਂ ਤੋਂ ਬਿਨ੍ਹਾਂ ਰਸੌਈ ਕਿਹਾ ਜਾ ਸਕਦਾ ਹੈ ਕੀ ਸੱਜਦੀ ਹੀ ਨਹੀਂ ਹੈ ਇਸ ਤਰ੍ਹਾਂ ਰਸੋਈ ਦੇ ਵਿੱਚ ਬਤਰਨ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ